ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਪੰਜਾਬੀ ਪੰਜਾਬ ਵਿੱਚ ਵੱਸਦੇ ਹਾਂ ਸਾਡੀ ਪੰਜਾਬੀ ਭਾਸ਼ਾ ਹੌਲੀ ਹੌਲੀ ਅਲੋਪ ਹੋਈ ਜਾ ਰਹੀ ਹੈ ਇਸ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਭਾਸ਼ਾ ਵੀ ਕਿਹਾ ਜਾਂਦਾ ਹੈ ਸਕੂਲਾਂ ਵਿੱਚ ਜੋ ਅੰਗਰੇਜ਼ੀ ਸੈਬਜੈਕਟ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਅੰਗਰੇਜ਼ੀ ਵਿੱਚ ਹੀ ਬੱਚਿਆਂ ਨੂੰ ਪੜ੍ਹਾਈਆਂ ਅਤੇ ਲਿਖਾਈਆਂ ਜਾ ਰਹੀਆਂ ਹਨ ਉਹ ਲਾਜ਼ਮੀ ਹੈ ਕਿ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਜੋ ਬੱਚੇ ਪੰਜਾਬੀ ਭਾਸ਼ਾ ਨੂੰ ਪੜ੍ਹ ਸਕਣ ਲਿਖ ਸਕਣ ਵਿਚਾਰ ਸਕਣ ਅਤੇ ਦੁਨੀਆਂ ਵਿੱਚ ਪੰਜਾਬੀ ਨਾਲ ਵਿਚਰ ਸਕਣ ਤਾਂ ਜੋ ਸਾਡਾ ਭਵਿੱਖ ਪੰਜਾਬੀ ਸੁਰੱਖਿਅਤ ਰਹੇ ਸਰਕਾਰੀ ਨੋਟਿਸ ਐਪਲੀਕੇਸ਼ਨਾਂ ਜੋ ਵੀ ਸਰਕਾਰੀ ਕਾਰਜ ਸਹੂਲਤਾਂ ਆਉਂਦੀਆਂ ਹਨ ਉਹ ਸਾਰੀਆਂ ਹੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਹੁੰਦੀਆਂ ਹਨ ਜੋ ਸਿਰਫ ਪੰਜਾਬੀ ਭਾਸ਼ਾ ਹੀ ਪੜ੍ਹ ਸਕਦੇ ਹਨ ਉਹਨਾਂ ਨੂੰ ਉਹ ਸਹੂਲਤਾਂ ਨਾ ਪੜ੍ਹ ਉਹ ਸਹੂਲਤਾਂ ਨਾ ਪੜ੍ਹਨ ਕਰਕੇ ਉਹਨਾਂ ਦਾ ਲਾਭ ਨਹੀਂ ਉਠਾ ਸਕਦੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਪੰਜਾਬੀ ਨੂੰ ਸਥਾਨ ਮਿਲਣਾ ਚਾਹੀਦਾ ਹੈ ਔਰ ਘਰ ਦਾ ਮਾਹੌਲ ਵੀ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਘਰਾਂ ਵਿੱਚ ਪੰਜਾਬੀ ਬੋਲੀਏ ਅਤੇ ਸਾਡੇ ਬੱਚੇ ਵੀ ਪੰਜਾਬੀ ਬੋਲ ਸਕਣ ਪੜ੍ਹ ਸਕਣ ਕਿਉਂਕਿ ਸਾਡੀ ਮਾਤ ਭਾਸ਼ਾ ਪੰਜਾਬੀ ਹੀ ਹੈ